ਬਰਤਨ ਧੋਣ ਵਿੱਚ ਇਹ ਯਕੀਨੀ ਬਣਾਉਣ ਲਈ ਕਈ ਮੁੱਖ ਕਦਮ ਸ਼ਾਮਲ ਹੁੰਦੇ ਹਨ ਕਿ ਉਹ ਸਹੀ ਢੰਗ ਨਾਲ ਸਾਫ ਕੀਤੇ ਗਏ ਹਨ ਪਕਵਾਨਾਂ ਵਿੱਚੋਂ ਕਿਸੇ ਵੀ ਬਚੇ ਹੋਏ ਭੋਜਨ ਨੂੰ ਸਕਰੈਪ ਕਰਕੇ ਸ਼ੁਰੂ ਕਰੋ ਢਿੱਲੇ ਮਲਵੇ ਨੂੰ ਹਟਾਉਣ ਲਈ ਗਰਮ ਪਾਣੀ ਨਾਲ ਬਰਤਨ ਕੁਰਲੀ ਕਰੋ ਅੱਗੇ ਸਪੰਜ ਜਾਂ ਕਟੋਰੇ 'ਤੇ ਡਿਸ਼ ਸਾਬਣ ਲਗਾਓ ਅਤੇ ਪਕਵਾਨਾਂ ਨੂੰ ਚੰਗੀ ਤਰ੍ਹਾਂ ਰਗੜੋ ਗਰੀਸ ਜਾਂ ਭੋਜਨ ਦੀ ਰਹਿੰਦ ਖੂੰਹਦ ਵਾਲੇ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿਓ ਤੇਲ ਯੁਕਤ ਪਕਵਾਨਾਂ ਲਈ ਡਿਸ਼ ਸਾਬਣ ਦੇ ਨਾਲ ਗਰਮ ਪਾਣੀ ਦੀ ਵਰਤੋਂ ਕਰੋ ਕਿਉਂਕਿ ਗਰਮੀ ਗਰੀਸ ਨੂੰ ਘੁਲਣ ਅਤੇ ਚੁੱਕਣ ਵਿੱਚ ਮਦਦ ਕਰਦੀ ਹੈ ਇਹ ਡਿਜ਼ੈਨਨ ਡਿਸ਼ ਸਾਬਣ ਜ਼ਿੱਦੀ ਤੇਲ ਨੂੰ ਹਟਾਉਣ ਲਈ ਖਾਸ ਕਰਕੇ ਪ੍ਰਭਾਵਸ਼ਾਲੀ ਹੁੰਦਾ ਹੈ ਰਗੜਨ ਤੋਂ ਬਾਅਦ ਸਾਰੇ ਸਾਬਣ ਅਤੇ ਰਹਿੰਦ ਖੂੰਹਦ ਨੂੰ ਹਟਾਉਣ ਲਈ ਗਰਮ ਚੱਲ ਰਹੇ ਪਾਣੀ ਦੇ ਹੇਠਾਂ ਬਰਤਨਾਂ ਨੂੰ ਕੁਰਲੀ ਕਰੋ ਅੰਤ ਵਿੱਚ ਸਾਫ ਪਕਵਾਨਾਂ ਨੂੰ ਸੁਕਾਉਣ ਵਾਲੇ ਰੈਕ ਜਾਂ ਤੌਲੀਏ ਵਿੱਚ ਹਵਾ ਵਿੱਚ ਸੁਕਾਉਣ ਲਈ ਰੱਖੋ ਵਾਧੂ ਸਵੱਛਤਾ ਲਈ ਤੁਸੀਂ ਬਰਤਨਾਂ ਨੂੰ ਸੁੱਕਾ ਪੂੰਜਣ ਲਈ ਇੱਕ ਸਾਫ ਕੱਪੜੇ ਜਾਂ ਤੌਲੀਏ ਦੀ ਵਰਤੋਂ ਵੀ ਕਰ ਸਕਦੇ ਹੋ